ਹਾਂਜੀ ਜੇਕਰ ਆਪਾਂ ਭੰਗੜੇ ਦੇ ਸਟੈਪ ਦੀ ਗੱਲ ਕਰੀਏ ਤਾਂ ਭੰਗੜੇ ਵਿੱਚ ਬਹੁਤ ਤਰ੍ਹਾਂ ਦੇ ਸਟੈਪ ਆਉਂਦੇ ਹਨ ਜਿਵੇਂ ਕਿ ਝੂਮਰ ਲੁੱਡੀ ਤਾਲ ਹੋਰ ਵੀ ਕਾਫੀ ਤਰ੍ਹਾਂ ਦੇ ਸਟੈਪ ਹੁੰਦੇ ਹਨ ਜੋ ਕਿ ਜਸ਼ਨ ਵਾਲੇ ਸੁਭਾਅ ਵਿੱਚ ਯੋਗਦਾਨ ਪਾਉਂਦੇ ਹਨ ਅਤੇ ਵਿਅਕਤੀ ਦੇ ਇੱਕ ਆਮ ਵਿਅਕਤੀ ਦਾ ਵੀ ਹੌਂਸਲਾ ਵਧਾਉਂਦੇ ਹਨ ਜਿਹੜਾ ਵਿਅਕਤੀ ਕਿਸੇ ਵੀ ਫੰਕਸ਼ਨ ਦੇ ਵਿੱਚ ਨਹੀਂ ਵੀ ਨੱਚਣਾ ਚਾਹੁੰਦਾ ਜੇਕਰ ਉਹ ਭੰਗੜਾ ਪੈਂਦਾ ਦੇਖ ਲੈਂਦਾ ਤਾਂ ਉਹ ਆਪਣੇ ਆਪ ਨੂੰ ਨਹੀਂ ਰੋਕ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਲਈ ਇਹ ਇੱਕ ਖੁਰਾਕ ਸਮਝ ਲਓ ਚਾਹੇ ਤੁਸੀਂ ਉਸ ਦਾ ਲੋਕ ਨਾਚ ਸਮਝ ਲਓ ਇਸ ਤੋਂ ਬਗੈਰ ਉਹ ਨਹੀਂ ਰਹਿ ਸਕਦਾ ਭੰਗੜੇ ਦੇ ਵਿੱਚ ਕਾਫੀ ਸਟੈਪ ਆਉਂਦੇ ਹਨ ਸੱਭਿਆਚਾਰਕ ਸਟੈਪ ਆ ਗਿਆ ਸੱਭਿਆਚਾਰਕ ਪ੍ਰੋਗਰਾਮ ਆ ਗਿਆ ਵਿਆਹ ਸ਼ਾਦੀਆਂ ਦੇ ਉੱਤੇ ਵੀ ਇਸ ਭੰਗੜੇ ਨੂੰ ਪਾਇਆ ਜਾਂਦਾ ਹੈ ਜੋ ਕਿ ਪੰਜਾਬ ਦਾ ਇੱਕ ਲੋਕ ਨਾਚ ਹੈ ਜੀ